ਖੁੱਲ੍ਹੇ ਪਾਣੀ ਵਿੱਚ ਸਾਨੂੰ ਸੁਰੱਖਿਅਤ ਰਹਿਣ ਲਈ ਤੈਰਾਕੀ ਕਰਦੇ ਸਮੇਂ ਸਾਨੂੰ ਬੋਟ ਵਿੱਚ ਜਾਣਾ ਚਾਹੀਦਾ ਹੈ ਜਾਂ ਸਾਨੂੰ ਆਪਣੇ ਜੋ ਜੈਕਟ ਪਾਉਣੀ ਚਾਹੀਦੀ ਹੈ ਜੋ ਪਾਣੀ ਵਾਲੀਆਂ ਜੈਕਟਾਂ ਹੁੰਦੀਆਂ ਹਨ ਉਹ ਪਾਉਣੀਆਂ ਚਾਹੀਦੀਆਂ ਹਨ ਇਸ ਲਈ ਸਾਨੂੰ ਖੁੱਲ੍ਹੇ ਪਾਣੀ ਵਿੱਚ ਤੈਰਾਕੀ ਕਰਦੇ ਸਮੇਂ ਆਪਣੇ ਆਪ ਨੂੰ ਸੁਰੱਖਿਅਤ ਰੱਖਣਾ ਚਾਹੀਦਾ ਹੈ ਧਿਆਨ ਨਾਲ ਸਾਨੂੰ ਖੁੱਲ੍ਹੇ ਪਾਣੀ ਵਿੱਚ ਤੈਰਨਾ ਚਾਹੀਦਾ ਹੈ ਅਤੇ ਇਸ ਦੇ ਅਤੇ ਵੱਡੀਆਂ ਪਾਣੀਆਂ ਵਾਲੀਆਂ ਜਿਵੇਂ ਤਿਲਕਣ ਵਾਲੀਆਂ ਜਗ੍ਹਾ ਹਨ ਉਹਨਾਂ 'ਤੇ ਸਾਨੂੰ ਧਿਆਨ ਨਾਲ ਚੱਲਣਾ ਚਾਹੀਦਾ ਹੈ ਸਾਨੂੰ ਆਪਣੇ ਆਲੇ ਦੁਆਲੇ ਦੇਖ ਕੇ ਉਹਨਾਂ ਚੱਟਾਨਾਂ ਉੱਪਰ ਜਾਣਾ ਚਾਹੀਦਾ ਹੈ ਚੱਟਾਨਾਂ ਉੱਪਰ ਜਾਣ ਲਈ ਸਾਨੂੰ ਪ੍ਰਬੰਧ ਪੂਰਾ ਕਰਕੇ ਲੈ ਕੇ ਜਾਣਾ ਚਾਹੀਦਾ ਹੈ ਇਸ ਲਈ ਸਾਨੂੰ ਤੇਜ਼ ਚੱਲਣ ਵਾਲੀਆਂ ਹਵਾਵਾਂ ਵਿੱਚ ਵੀ ਆਪਣੇ ਆਪ ਨੂੰ ਸੁਰੱਖਿਅਤ ਰੱਖਣ ਲਈ ਆਪਣਾ ਪ੍ਰਬੰਧ ਕਰਕੇ ਜਾਣਾ ਚਾਹੀਦਾ ਹੈ ਤਾਂ ਜੋ ਅਸੀਂ ਖੁੱਲ੍ਹੇ ਪਾਣੀ ਵਿੱਚ ਤੈਰਾਕੀ ਕਰਦੇ ਸਮੇਂ ਅਤੇ ਤਿਲਕਣ ਵਾਲੀਆਂ ਚੱਟਾਨਾਂ ਆਲਗੀ ਤੇਜ਼ ਹਵਾਵਾਂ ਵਿੱਚ ਆਪਣੀ ਸੁਰੱਖਿਆ ਕਰ ਸਕੀਏ